ਮੈਂ ਨਵਾਂ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਇੱਥੇ ਦਾ ਜਿਹੜਾ ਬਜ਼ਾਰ ਆ ਮਤਲਬ ਕਿ ਉਹ ਮੈਨੂੰ ਨੇੜੇ ਪੈਂਦਾ ਹੈ ਅਤੇ ਮੈਂ ਆਪਣੀ ਮੰਮੀ ਨਾਲ ਸਬਜ਼ੀ ਵਗੈਰਾ ਖਰੀਦਣ ਜਾਂਦੀ ਹੁੰਦੀ ਹਾਂ ਅਤੇ ਇੱਥੇ ਜਿਹੜੇ ਕਿਸਾਨ ਆ ਉਹ ਆਪਣੀ ਫਸਲ ਵਗੈਰਾ ਵੀ ਵੇਚਣ ਆਉਂਦੇ ਆ ਅਤੇ ਜਿਹੜੇ ਇੱਥੇ ਦੀ ਸਬਜ਼ੀਆਂ ਏ ਉਹ ਜਿਹੜੀਆਂ ਜਿਹੜੇ ਜਿਹੜੇ ਇੱਥੇ ਸਬਜ਼ੀਆਂ ਉਹ ਕਾਫੀ ਮਤਲਬ ਵਧੀਆ ਹੈ ਇਹਦੇ ਵਿੱਚ ਕੋਈ ਟੀਕਾ ਵਗੈਰਾ ਨਹੀਂ ਲੱਗਿਆ ਹੁੰਦਾ ਉਹ ਤਾਜ਼ੀਆਂ ਹੁੰਦੀਆਂ ਹੈ ਅਤੇ ਜਿਹੜੀ ਇੱਕ ਜਿਹੜੀ ਮਤਲਬ ਕਿ ਇੱਕ ਜਿਹੜੀ ਦੁਕਾਨ 'ਤੇ ਸਬਜ਼ੀ ਪੰਜਾਹ ਰੁਪਏ ਦੀ ਮਿਲਦੀ ਉਹ ਇੱਥੇ ਤੀਹ ਰੁਪਏ ਦੀ ਮਿਲਦੀ ਆ ਅਤੇ ਇਹ ਜਿਹੜੀ ਇਹ ਜਿਹੜਾ ਬਜ਼ਾਰ ਆ ਬਜ਼ ਬਜ਼ਾਰ ਆ ਇਹ ਸਾ ਸੱਤੋਂ ਦਿਨ ਚੱਲਦਾ ਰਹਿੰਦਾ ਆ ਜਿਹਦੇ ਜਿਹਦੇ ਵਿੱਚ ਜਿਵੇਂ ਲੋਕ ਕਾਫੀ ਵਧੀਆ ਮਤਲਬ ਕਿ ਸਬਜ਼ੀਆਂ ਖਰੀਦ ਸਕਦੇ ਆ ਅਤੇ ਇੱਥੇ ਜਿਹੜੇ ਇੱਥੇ ਜਿਹੜੇ ਇੱਥੇ ਦੇ ਸਬਜ਼ੀਆਂ ਹੈਗੀਆਂ ਮਤਲਬ ਤਾਜ਼ੀਆਂ ਹੁੰਦੀਆਂ ਨਾ ਕੋਈ ਟੀਕਾ ਵਗੈਰਾ ਲੱਗਿਆ ਹੁੰਦਾ ਆ ਅਤੇ ਜਿਹੜੀ ਇਹਦੀ ਗੁਣਵੰਤਾ ਇਹ ਚੀਜ਼ ਆ ਕਿ ਹਾਂ ਇਹਦੇ ਵਿੱਚ ਕੋਈ ਟੀਕਾ ਵਗੈਰਾ ਨਹੀਂ ਲੱਗਿਆ ਹੁੰਦਾ ਅਤੇ ਹਾਂ ਇਹ ਕਿਫਾਇਤੀ ਹੈ